ਪਿੰਡਾਂ ਵਿੱਚ ਦਵਾਖਾਨੇ ਘੱਟ ਹੁੰਦੇ ਨੇ ਅਤੇ ਅਸੀਂ ਆਪਣੇ ਵੱਡੇ ਬਜ਼ੁਰਗਾਂ ਤੋਂ ਘਰੇਲੂ ਨੁਸਖਿਆਂ ਤੋਂ ਜਿਹੜੀ ਛੋਟੀ ਮੋਟੀ ਤਕਲੀਫ ਜਾਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਠੀਕ ਕਰ ਲੈਂਦੇ ਹੈ ਪਿੰਡ ਵਿੱਚ ਕਬਜ਼ ਦੀ ਇੱਕ ਆਮ ਬਿਮਾਰੀ ਹੈਗੀ ਹੈ ਕਬਜ਼ ਲਈ ਵੱਡੇ ਬਜ਼ੁਰਗ ਦੱਸਦੇ ਨੇ ਕਿ ਤੁਸੀਂ ਪੁਦੀਨੇ ਦੀ ਚਟਣੀ ਖਾਓ ਰੋਟੀ ਦੇ ਨਾਲ ਅਤੇ ਸਵੇਰੇ ਉੱਠ ਕੇ ਗਰਮ ਪਾਣੀ ਦੇ ਨਾਲ ਅਜਵੈਣ ਅਤੇ ਕਾਲਾ ਨਮਕ ਇਹ ਪੀ ਲਓ ਇਹ ਸਭ ਕਰਨ ਦੇ ਨਾਲ ਕਬਜ਼ ਦੀ ਬਿਮਾਰੀ ਹੌਲੇ ਹੌਲੇ ਘੱਟ ਕ ਹੋ ਜਾਂਦੀ ਹੈ ਵੱਡੇ ਬਜ਼ੁਰਗ ਇਹ ਵੀ ਦੱਸਦੇ ਹੈਗੇ ਕਿ ਤੁਸੀਂ ਆਪਣੀ ਰੋਟੀ ਦੇ ਨਾਲ ਲੱਸੀ ਜ਼ਰੂਰ ਪੀਓ ਲੱਸੀ ਜਾਂ ਛਾਛ ਪੀਣ ਦੇ ਨਾਲ ਤੁਹਾਡੀ ਇਹ ਤਕਲੀਫ਼ ਦੂਰ ਹੋ ਜਾਉਗੀ